ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰੀਆ ਸ਼ਰਮਾ ਹੈ ਅਤੇ ਮੈਂ ਸਵੇਰੇ ਤੁਹਾਡੀ ਏਜੰਸੀ 'ਚੋਂ ਕੈਬ ਬੁੱਕ ਕੀਤੀ ਸੀ ਪਰ ਉਹ ਸਮੇਂ ਸਿ ਸਿਰ ਨਾ ਪਹੁੰਚਣ ਕਰਕੇ ਮੈਨੂੰ ਰੱਦ ਕਰਨੀ ਪਈ ਮੈਂ ਬਾਰ੍ਹਾਂ ਵਜੇ ਦਾ ਟਾਈਮ ਦਿੱਤਾ ਸੀ ਪਰ ਉਹ ਉਸ ਤੋਂ ਵੀ ਲੇਟ ਸੀ ਜਿਸ ਕਰਕੇ ਮੈਨੂੰ ਆਪਣੇ ਪੇਪਰ ਦੇਣ ਜਾਣਾ ਸੀ ਉਸ ਲਈ ਬਹੁਤ ਹੀ ਦੇਰੀ ਹੋ ਰਹੀ ਸੀ ਜਿਸ ਕਰਕੇ ਮੈਨੂੰ ਰੱਦ ਕਰਨੀ ਪਈ ਹੁਣ ਮੈਂ ਦੂਜੀ ਕੈਬ ਬੁੱਕ ਕਰ ਲਿਤੀ ਹੈ ਤਾਂ ਮੇਰੀ ਕਿਰਪਾ ਕਰਕੇ ਤੁਹਾਨੂੰ ਬੇਨਤੀ ਹੈ ਕਿ ਮੇਰੇ ਪੈਸੇ ਰਿਫੰਡ ਕੀਤੇ ਜਾਣ ਤਾਂ ਜੋ ਮੈਨੂੰ ਪਰੇਸ਼ਾਨੀ ਨਾ ਝੱਲਣੀ ਪਵੇ ਧੰਨਵਾਦ